ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਮਨੀ ਕਮਿਊਨੀਕੇਸ਼ਨ ਤੋਂ ਬੋਲ ਰਹੇ ਹੋ ਮੈਂ ਤੁਹਾਡੀ ਸ਼ੋਪ ਪਰ ਸੇ ਇੱ ਸ਼ੋਪ ਪਰ ਤੋਂ ਇੱਕ ਫ਼ੋਨ ਔਡਰ ਕੀਤਾ ਸੀ ਜੋ ਮੈਨੂੰ ਪੂਰੇ ਟਾਈਮ ਪਰ ਮਿਲ ਗਿਆ ਉਹ ਬਹੁਤ ਵਧੀਆ ਫ਼ੋਨ ਹੈ ਇਸ ਦਾ ਕੈਮਰਾ ਬਹੁਤ ਵਧੀਆ ਹੈ ਸਪੀਕਰ ਵੀ ਇਸ ਦਾ ਬਹੁਤ ਵਧੀਆ ਇਸ ਦਾ ਗਲਾਸ ਬਹੁਤ ਵਧੀਆ ਇਸ 'ਚ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਹਨ ਇਸ 'ਚ ਅਵਾਜ਼ ਪੂਰੀ ਕਲੀਅਰ ਆਉਂਦੀ ਹੈ ਇਹ ਹੈਂਗ ਇਹ ਹੈਂਗ ਵੀ ਨਹੀਂ ਹੁੰਦਾ ਇਸ ਦੀ ਇਸ ਦੀ ਕੋਐਲੀਟੀ ਬਹੁਤ ਵਧੀਆ ਹੈ ਜੇ ਇਸ ਦੇ ਨਾਲ਼ ਦਾ ਕੋਈ ਨਵਾਂ ਫ਼ੋਨ ਆਉਂਦਾ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਮੈਂ ਤੁਹਾਡੇ ਮੈਂ ਤੁਹਾਡੀ ਸ਼ੋਪ ਪਰ ਤੋਂ ਰੈਡਮੀਂ ਰੈਡਮੀਂ ਕੰਪਨੀ ਦਾ ਫ਼ੋਨ ਲਿੱਤਾ ਸੀ ਤਾਂ ਜੇ ਇਸ ਦੇ ਨਾਲ਼ ਦਾ ਕੋਈ ਫ਼ੋਨ ਆਉਂਦਾ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਇਹ ਫ਼ੋਨ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ